ਰੇਲ ਗੱਡੀ ਦਾ ਸਫਰ ਸਭ ਤੋਂ ਵਧੀਆ ਹੈ ਮੈਨੂੰ ਤਾਂ ਰੇਲ ਗੱਡੀ ਵਿੱਚ ਸਫਰ ਕਰਨ ਦਾ ਬਹੁਤ ਅੱਛਾ ਲੱਗਦਾ ਹੈ ਰੇਲ ਗੱਡੀ ਦੀ ਦੂਰ ਜਾਣ ਵਾਸਤੇ ਸੀਟ ਵੀ ਬੁੱਕ ਕਰਵਾਈ ਜ਼ਾ ਜਾ ਸਕਦੀ ਹੈ ਇੱਕ ਹੋਰ ਰੇਲ ਗੱਡੀ ਚ ਸਫਰ ਕਰਨ ਦਾ ਫਾਇਦਾ ਕਿ ਘਰੋਂ ਖਾਣਾ ਨਹੀਂ ਲਿਜਾਣਾ ਪੈਂਦਾ ਖਾਣਾ ਵੀ ਉਸ ਤੋਂ ਉਸ ਵਿੱਚ ਹੀ ਮਿਲਦਾ ਹੈ ਅਤੇ ਹਰ ਚੀਜ਼ ਪਾਣੀ ਸਾਰੀ ਸੁਵਿਧਾ ਹੁੰਦੀ ਹੈ ਔਰ ਸੀਟਾਂ ਵੀ ਓ ਬਰਥ ਸੀਟਾਂ ਦਾ ਬਣੀਆਂ ਹੁੰਦੀਆਂ ਹਨ ਜਿਹਦੇ ਵਿੱਚ ਆਰਾਮ ਨਾਲ ਬੰਦਾ ਸੌ ਸਕਦਾ ਅਤੇ ਕੋਈ ਇੰਜਨ ਦਾ ਸ਼ੌਰ ਪਹੀਏ ਦਾ ਸ਼ੌਰ ਨਹੀਂ ਹੁੰਦਾ ਮੈਂ ਰੇਲ ਗੱਡੀ ਤੱਕ ਬੋਂਬੇ ਤੱਕ ਯਾਤਰਾ ਕੀਤੀ ਹੈ ਅਤੇ ਮੈਨੂੰ ਕੋਈ ਵੀ ਤਕਲੀਫ ਨਹੀਂ ਹੋਈ ਮੈਨੂੰ ਬੋਂਬੇ ਤੱਕ ਜਾਣ ਲਈ ਬਹੁਤ ਮਜ਼ਾ ਆਇਆ ਅਤੇ ਆਰਾਮਦਾਇਕ ਯਾਤਰਾ ਹੋਈ ਅਤੇ ਕੋਈ ਵੀ ਉਸ ਵਿੱਚ ਸ ਕੋਈ ਵੀ ਯਾਤਰੀ ਪਰੇਸ਼ਾਨ ਨਹੀਂ ਕਰਦਾ ਸਾਰੇ ਆਪਣੀ ਆਪਣੀ ਸੀਟ 'ਤੇ ਬੈਠ ਕੇ ਮਜ਼ੇ ਲੈਂਦੇ ਹਨ ਅਤੇ ਕੋਈ ਵੀ ਕਿਸੇ ਨੂੰ ਇੱਕ ਦੂਜੇ ਨੂੰ ਤੰਗ ਨਹੀਂ ਕਰਦਾ ਹਰ ਚੀਜ਼ ਮਿਲ ਜਾਂਦੀ ਹੈ